ਪੁਰਾਣੀ ਹਾਰਡ ਕਾਪੀ ਅਤੇ ਨਵੀਂ ਡਿਜੀਟਲ ਫੋਟੋਆਂ ਵਿੱਚ ਬਹੁਤ ਜ਼ਿਆਦਾ ਫਰਕ ਹੈ ਪੁਰਾਣੀ ਹਾਰਡ ਕਾਪੀ ਨਾਲ ਸਾਡੀਆਂ ਬਹੁਤ ਸਾਰੀਆਂ ਭਾਵਨਾਵਾਂ ਜੁੜੀਆਂ ਹੁੰਦੀਆਂ ਹਨ ਪਰ ਨਵੀਂ ਡਿਜੀਟਲ ਫੋਟੋ ਵਿੱਚ ਸਾਡੀ ਕੋਈ ਭਾਵਨਾ ਨਹੀਂ ਹੁੰਦੀ ਕਿਉਂਕਿ ਪੁਰਾਣੇ ਸਮੇਂ ਵਿੱਚ ਘਰਾਂ ਵਿੱਚ ਹੀ ਫੋਟੋਆਂ ਖਿੱਚੀਆਂ ਜਾਂਦੀਆਂ ਸਨ ਜ਼ਿਆਦਾਤਰ ਫੋਟੋ ਖਿੱਚੀ ਵੀ ਨਹੀਂ ਜਾਂਦੀ ਸੀ ਅਗਰ ਜੇਕਰ ਖਿੱਚੀ ਜਾਂਦੀ ਸੀ ਤਾਂ ਘਰਾਂ ਵਿੱਚ ਹੀ ਖਿੱਚੀਆਂ ਜਾਂਦੀਆਂ ਸਨ ਉਹ ਜਿਹੜੀ ਫੋਟੋ ਖਿੱਚੀ ਜਾਂਦੀ ਸੀ ਉਹ ਸਾਡੇ ਹੱਥਾਂ ਵਿੱਚ ਆਉਂਦੀ ਸੀ ਜਿਸ ਨਾਲ ਸਾਡੀਆਂ ਬਹੁਤ ਭਾਵਨਾਵਾਂ ਜੁੜੀਆਂ ਹੁੰਦੀਆਂ ਸਨ ਉਸ ਵਿੱਚ ਸਾਡੇ ਸਾਡਾ ਪੁਰਾਣਾ ਸੱਭਿਆਚਾਰ ਸਾਰਾ ਹੁੰਦਾ ਸੀ ਪਰ ਅੱਜ ਕੱਲ੍ਹ ਨਵੀਆਂ ਡਿਜੀਟਲ ਫੋਟੋਆਂ ਵਿੱਚ ਕੋਈ ਭਾਵਨਾ ਨਹੀਂ ਜੁੜੀ ਇਸ ਵਿੱਚ ਇਹ ਸਿਰਫ ਫੋਨ ਦਾ ਹੀ ਸ਼ਿੰਗਾਰ ਹਨ ਇਸ ਨੂੰ ਅਸੀਂ ਪੈਨ ਡਰਾਈਵ ਪੈਨ ਡਰਾਈਵ ਰਾਹੀਂ ਕੰਪਿਊਟਰ ਵਿੱਚ ਵੇਖ ਸਕਦੇ ਹਾਂ ਜੋ ਕਢਾਉਣ ਉਸ ਵਿੱਚ ਹੀ ਰਹਿੰਦੀਆਂ ਹਨ ਇਹਨਾਂ ਨੂੰ ਕਢਾਉਣ ਦਾ ਕੋਈ ਚਾਅ ਨਹੀਂ ਹੁੰਦਾ ਪੁਰਾਣੀ ਹਾਰਡ ਕਾਪੀ ਹੁੰਦੀ ਸੀ ਜਿਹੜੀ ਉਹ ਸਾਡੇ ਹੱਥਾਂ ਵਿੱਚ ਹੁੰਦੀ ਸੀ ਇਸ ਵਿੱਚ ਸਾਡਾ ਪੁਰਾਣਾ ਸੱਭਿਆਚਾਰ ਹੁੰਦਾ ਸੀਗਾ ਇਸ ਵਿੱਚ ਸਾਡੇ ਪੁਰਾਣੇ ਬਜ਼ੁਰਗ ਹੁੰਦੇ ਸਨ ਜੋ ਕਿ ਫੋਟੋਆਂ ਜ਼ਿਆਦਾਤਰ ਘਰ ਵਿੱਚ ਹੀ ਖਿੱਚੀਆਂ ਜਾਂਦੀਆਂ ਸਨ ਇਹ ਸਾਡੇ ਹੱਥਾਂ ਵਿੱਚ ਹਾਰਡ ਕਾਪੀ ਹੁੰਦੀ ਸੀ ਜਿਸ ਨੂੰ ਵੇਖ ਕੇ ਸਾਨੂੰ ਸਾਡਾ ਪੁਰਾਣਾ ਸੱਭਿਆਚਾਰ ਯਾਦ ਰਹਿੰਦਾ ਹੈ